ਮੇਰਾ ਨਾਮ ਅਤੁਲ ਮੈਂ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੇਰੀ ਉਮਰ ਅਠਾਰਾਂ ਹੈ ਮੈਂ ਹਮੇਸ਼ਾ ਆਪਣੇ ਦੋਸਤਾਂ ਨਹੀਂ ਮੈਂ ਪਹਿਲਾਂ ਇਕੱਲਾ ਹੀ ਗਾਉਂਦਾ ਸੀ ਪਰ ਹੁਣੇ ਥੋੜ੍ਹਾ ਟਾਈਮ ਪਹਿਲਾਂ ਹੀ ਮੇਰੇ ਦੋ ਦੋਸਤ ਬਣੇ ਹੈ ਜਿੰਨੇ ਕਿ ਖੁਦ ਵੀ ਗਿਟਾਰ ਵਜਾਉਣਾ ਜਾਣਦੇ ਨੇ ਤੇ ਮੈਂ ਉਹਨਾਂ ਨਾਲ ਹੀ ਹੁਣ ਗਾਉਂਦਾ ਹਾਂ ਉਹਨਾਂ ਵਿੱਚੋਂ ਇੱਕ ਦੋਸਤ ਜਿਹੜਾ ਮੇਰਾ ਹੈ ਉਹ ਡਰਮ ਵਜਾਉਂਦਾ ਹੈ ਇੱਕ ਜਿਹੜਾ ਗਿਟਾਰ ਵਜਾਉਂਦਾ ਹੈ ਅਤੇ ਅਸੀਂ ਤਿੰਨੇ ਜਣੇ ਬਹੁਤ ਅੱਛੇ ਤਰੀਕੇ ਨਾਲ ਗਾਉਂਦੇ ਹੈ ਉਹ ਵੀ ਕਈ ਵਾਰ ਕਹਿੰਦੇ ਹਾਂ ਕਿ ਅਸੀਂ ਆਪਣੀ ਮਰਜ਼ੀ ਦਾ ਗਾਣਾ ਚੁੰਣਦੇ ਹਾਂ ਕਈ ਵਾਰੀ ਮੈਂ ਆਪਣੀ ਮਰਜ਼ੀ ਦਾ ਗਾਣਾ ਚੁੰਣਦਾ ਅਤੇ ਅਸੀਂ ਸਾਰੇ ਪਹਿਲਾਂ ਇੱਕ ਦੋ ਦਿਨ ਉਹ ਗਾਣੇ ਨੂੰ ਰੇਹਸ ਕਰਦੇ ਹਾਂ ਫਿਰ ਅਸੀਂ ਉਹ ਸਾਰੇ ਜਣੇ ਮਿਲ ਕੇ ਉਹ ਗਾਣੇ ਨੂੰ ਗਾਉਂਦੇ ਹਨ ਜੋ ਕਿ ਬਹੁਤ ਵਧੀਆ ਹੁੰਦਾ ਹੈ ਮੈਨੂੰ ਗਾਉਂਦੇ ਵਕਤ ਮਜ਼ਾ ਵੀ ਬਹੁਤ ਆਉਂਦਾ ਹੈ ਅਸੀਂ ਹੁਣੇ ਥੋੜ੍ਹਾ ਟਾਈਮ ਪਹਿਲਾਂ ਉਹਦੇ ਕੋਲ ਮੇਰਾ ਇੱਕ ਜੋ ਦੋਸਤ ਸੀ ਉਹਦੇ ਕੋਲ ਇੱਕ ਹਾਲ ਵੀ ਪਿਆ ਹੋਇਆ ਸੀ ਜਿੱਥੇ ਹੁਣ ਅਸੀਂ ਜਾ ਕੇ ਪ੍ਰੈਕਟਿਸ ਕਰਦੇ ਹਾਂ ਗਾਣਿਆਂ ਦੀ ਜੋ ਕਿ ਬਹੁਤ ਮੈਨੂੰ ਅੱਛਾ ਲੱਗਦਾ ਅਤੇ ਮੇਰੇ ਦੋਸਤ ਵੀ ਬਹੁਤ ਖੁਸ਼ ਹੈ ਜਦੋਂ ਅਸੀਂ ਸਾਰੇ ਗਾਉਂਦੇ ਹਾਂ